ਹਾਂਜੀ ਮੈਂ ਲਿਖਣਾ ਚਾਹੁੰਦੀ ਹਾਂ ਮੈਂ ਲਿਖਣ ਦੀ ਬਹੁਤ ਸ਼ੌਕੀਨ ਹੈਗੀ ਹਾਂ ਸਾਡੇ ਮਤਲਬ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਸਾਡੇ ਆਲੇ ਦੁਆਲੇ ਬਹੁਤ ਹੀ ਇਹੋ ਜਿਹੇ ਗੰਭੀਰ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਹੜੀਆਂ ਕਿ ਮੈਂ ਆਪਣੇ ਮੰਤਰੀ ਸਾਹਿਬ ਤੱਕ ਆਪਣੇ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਾਉਣਾ ਚਾਹੁੰਦੀ ਹਾਂ ਉਹਨਾਂ ਬਾਰੇ ਮੈਂ ਲਿਖਿਆ ਵੀ ਬੜੀ ਵਾਰੀ ਆ ਅਤੇ ਪਰ ਇਹ ਕੀ ਉਹ ਉਹਨਾਂ ਤੱਕ ਪਹੁੰਚ ਨਹੀਂ ਸਕਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣੀ ਵਰਜਿਤ ਆ ਵਰਜਿਤ ਤਾਂ ਨਹੀਂ ਹੈਗੀ ਚਲੋ ਪਰ ਇਹ ਕਿ ਸਾਡਾ ਲਿਖਿਆ ਹੋਇਆ ਉਹਨਾਂ ਤੱਕ ਪਹੁੰਚਦਾ ਨਹੀਂ ਹੈ ਇਸ ਲਈ ਮੇਰੇ ਹਿਸਾਬ ਨਾਲ ਤਾਂ ਉਹ ਵਰਜਿਤ ਹੀ ਆ ਕਿਉਂਕਿ ਮੈਂ ਇੱਕ ਵਾਰੀ ਨਹੀਂ ਕਈ ਵਾਰੀ ਮੈਂ ਲਿਖਿਆ ਵੀ ਆ ਪਰ ਮੈਨੂੰ ਉਹਦਾ ਕੋਈ ਜਵਾਬ ਨਹੀਂ ਮਿਲਿਆ ਕਿਉਂਕਿ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਦੇ ਪੀਏ ਜਾਂ ਛੋਟੇ ਮੰਤਰੀ ਆ ਉਹਨਾਂ ਤੱਕ ਪਹੁੰਚਦੀ ਆ ਉਹ ਅੱਗੇ ਜਾਣ ਹੀ ਨਹੀਂ ਦਿੰਦੇ ਸਾਰੇ ਸਿਫਾਰਿਸ਼ ਵਾਲੇ ਬੈਠੇ ਹੁੰਦੇ ਨੇ ਅਤੇ ਸਾਡੇ ਨੋਰਮਲ ਬੰਦੇ ਨੇ ਇੱਥੇ ਸੁਣੀ ਹੀ ਨਹੀਂ ਜਾਂਦੀ ਇਸ ਲਈ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਜਿਹੜੀ ਗੱਲ ਆ ਇਹ ਜਿਹੜੀਆਂ ਅਸੀਂ ਆਪਣੇ ਮੰਤਰੀ ਸਾਹਿਬ ਨਾਲ ਕਰਨਾ ਚਾਹੁੰਦੇ ਆ ਚਿੱਠੀ ਦੇ ਥਰੂ ਇਹ ਉਹਨਾਂ ਤੱਕ ਡਾਇਰੈਕਟ ਪਹੁੰਚਣੀ ਚਾਹੀਦੀ ਹੈ ਪਰ ਪਹੁੰਚ ਨਹੀਂ ਪਾਉਂਦੀ ਇਸ ਵਿਸ਼ੇ 'ਚ ਮੈਂ ਕੁਛ ਕਹਿ ਵੀ ਨਹੀਂ ਸਕਦੀ ਹੁਣ ਕਿਉਂਕਿ ਸਾਡੀਆਂ ਲਿਖੀਆਂ ਹੋਈਆਂ ਚਿੱਠੀਆਂ ਉਹਨਾਂ ਤੱਕ ਪਹੁੰਚੀਆਂ ਹੀ ਨਹੀਂ ਹੈ ਪਰ ਮੈਂ ਇਹ ਅੱਗੇ ਜੇ ਕ ਕਦੇ ਉਹ ਮੈਨੂੰ ਮਿਲੇ ਜਾਂ ਮੇਰੀ ਕੋਈ ਇਹੋ ਜਿਹੀ ਕਿਸਮਤ ਹੋਈ ਕਿ ਮੈਂ ਉਹਨਾਂ ਨੂੰ ਮਿਲ ਪਾਵਾਂ ਅਤੇ ਮੈਂ ਉਹਨਾਂ ਅੱਗੇ ਬੇਨਤੀ ਜ਼ਰੂਰ ਕਰਾਂਗੀ ਕਿ ਇਹਦੇ ਵਿੱਚ ਸੁਧਾਰ ਲਿਆਇਆ ਜਾਵੇ ਤਾਂ ਜੇ ਸਾਡੀ ਗੱਲਬਾਤ ਤੁਹਾਡੇ ਨਾਲ ਡਾਇਰੈਕਟ ਹੋ ਸਕੇ